ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦਾ ਸਮਾਂ ਭੱਜ ਦੌੜ ਦਾ ਸਮਾਂ ਹੈ ਜਿਸ ਦੇ ਵਿੱਚ ਹਰ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਇੰਨਾਂ ਉਲਝਿਆ ਹੋਇਆ ਹੈ ਕਿ ਉਸ ਨੂੰ ਸਰੀਰਕ ਥਕਾਵਟ ਤਾਂ ਹੈ ਪਰ ਉਸਦੇ ਨਾਲ ਮਾਨਸਿਕ ਤਨਾਵ ਬਹੁਤ ਜ਼ਿਆਦਾ ਹੈ ਇਸ ਮਾਨਸਿਕ ਤਨਾਵ ਦੇ ਨਾਲ ਉਸ ਦੇ ਸੁਭਾਅ ਦੇ ਵਿੱਚ ਚਿੜਚਿੜਾਪਣ ਅਤੇ ਗੁੱਸਾ ਬਹੁਤ ਜ਼ਿਆਦਾ ਵੱਧ ਗਿਆ ਹੈ ਯੋਗ ਇੱਕ ਅਜਿਹਾ ਸਾਧਨ ਹੈ ਜਿਸ ਨਾਲ ਵਿਅਕਤੀ ਸਰੀਰਕ ਅਤੇ ਮਾਨਸਿਕ ਦੋਵੇਂ ਤਰ੍ਹਾਂ ਦੀ ਸ਼ਾਂਤੀ ਪ੍ਰਾਪਤ ਕਰ ਸਕਦਾ ਹੈ ਜੇਕਰ ਇੱਕ ਬੰਦਾ ਮਾਨਸਿਕ ਤੌਰ 'ਤੇ ਖੁਸ਼ ਅਤੇ ਤੰਦਰੁਸਤ ਰਹਿੰਦਾ ਹੈ ਤਾਂ ਉਹ ਆਪਣੇ ਬਾਕੀ ਸਰੀਰਕ ਕੰਮਾਂ ਨੂੰ ਵੀ ਬਹੁਤ ਚੰਗੇ ਢੰਗ ਨਾਲ ਕਰ ਸਕਦਾ ਹੈ ਪਰ ਯੋਗ ਆਸਾਨ ਨਹੀਂ ਹੈ ਯੋਗ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਤੌਰ 'ਤੇ ਘਰੇਲੂ ਔਰਤਾਂ ਨੂੰ ਉਹਨਾਂ ਦੇ ਕੰਮ ਇੰਨੇ ਜ਼ਿਆਦਾ ਹੁੰਦੇ ਨੇ ਕਿ ਉਹ ਆਪਣੇ ਸਮੇਂ ਨੂੰ ਕੱਢ ਕੇ ਯੋਗ ਦੇ ਵਿੱਚ ਜਾਣਾ ਜਾਂ ਯੋਗ ਕਰਨਾ ਬਹੁਤ ਹੀ ਮੁਸ਼ਕਿਲ ਸਮਝਦੀਆਂ ਹਨ ਪਰ ਜੇ ਅਸੀਂ ਅੱਜ ਦੇ ਯੁੱਗ ਦੇ ਵਿੱਚ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਹੈ ਤਾਂ ਸਾਨੂੰ ਯੋਗ ਕਰਨਾ ਚਾਹੀਦਾ ਹੈ ਅਸੀਂ ਸਰੀਰਕ ਤੌਰ 'ਤੇ ਥਕਾਵਟ ਮਹਿਸੂਸ ਕਰਦੇ ਹਾਂ ਪਰ ਜੇਕਰ ਅਸੀਂ ਯੋਗ ਨੂੰ ਸਹੀ ਢੰਗ ਨਾਲ ਕੀ ਕਰੀਏ ਤਾਂ ਸਾਡੀਆਂ ਬਹੁਤ ਸਾਰੀਆਂ ਜੋ ਬਿਮਾਰੀਆਂ ਹਨ ਉਹਨਾਂ ਨੂੰ ਦੂਰ ਕਰ ਸਕਦੇ ਹਾਂ ਜਿਵੇਂ ਕਿ ਮੈਨੂੰ ਵੀ ਬਹੁਤ ਪ੍ਰੋਬਲਮਸ ਸਨ ਜਿਹਦੇ ਵਿੱਚ ਮੈਂ ਯੋਗ ਨਾਲ ਆਪਣੇ ਮੋਟਾਪੇ ਤੋਂ ਲੈ ਕੇ ਆਪਣੇ ਗੁੱਸੇ ਤੱਕ ਨੂੰ ਕੰਟਰੋਲ ਕੀਤਾ ਹੈ ਇਸ ਦੇ ਨਾਲ ਮੈਂ ਸਰੀਰਕ ਤੌਰ 'ਤੇ ਤੰਦਰੁਸਤ ਤਾਂ ਹੋਈ ਹੀ ਹਾਂ ਪਰ ਆਪਣੇ ਗੁੱਸੇ ਨੂੰ ਕਾਬੂ ਕਰਕੇ ਮੈਂ ਮਾਨਸਿਕ ਤੰਦਰੁਸਤ ਵੀ ਮੈਂ ਮਹਿਸੂਸ ਕਰਦੀ ਹਾਂ ਮੇਰੇ ਕੰਮ ਕਰਨ ਦੀ ਜੋ ਸਮਰੱਥਾ ਹੈ ਉਸ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਆਇਆ ਹੈ ਮੇਰੇ ਮੁਤਾਬਿਕ ਹਰ ਵਿਅਕਤੀ ਨੂੰ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਯੋਗ ਜ਼ਰੂਰ ਕਰਨਾ ਚਾਹੀਦਾ ਹੈ